ਸਾਡੀ ਰੋਜ਼ ਮਰਾ ਜ਼ਿੰਦਗੀ ਵਿੱਚ ਬਹੁਤ ਟੈਕਨੋਲੋਜੀ ਹਨ ਜਿਹਨਾਂ ਤੋਂ ਬਿਨਾਂ ਅਸੀਂ ਨਹੀਂ ਸਕਦੇ ਪਰ ਆਮ ਕਰਕੇ ਤਾਂ ਫੋਨ ਮੋਬਾਈਲ ਫੋਨ ਅਤੇ ਲੈਪਟੋਪ ਇਹ ਟੈਕਲੋਲਜੀਆਂ ਹਨ ਜਿਹਨਾਂ ਜਿਹਨਾਂ ਤੋਂ ਬਿਨਾਂ ਅਸੀਂ ਨਹੀਂ ਰਹਿ ਸਕਦੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਜਿਵੇਂ ਕਿ ਮੋਬਾਈਲ ਫੋਨ ਹੋ ਗਿਆ ਇਸ ਤੋਂ ਬਿਨਾਂ ਨਹੀਂ ਰਿਹਾ ਜਾ ਸਕਦਾ ਜਿਵੇਂ ਕਿ ਹੁਣ ਮੈਂ ਯੂਪੀਐਸਸੀ ਦੀ ਤਿਆਰੀ ਕਰਦਾ ਹਾਂ ਅਤੇ ਮੇਰੇ ਕੁਝ ਐਪਸ ਨੇ ਕੁਝ ਸਟਡੀ ਮਟੀਰੀਅਲ ਹੁੰਦਾ ਹੈ ਜੋ ਕਿ ਮੇਰੇ ਮੋਬਾਈਲ ਫੋਨ ਵਿੱਚ ਹੀ ਚੱਲਦਾ ਹੈ ਅਤੇ ਮੈਂ ਲੈਕਚਰ ਲਗਾਉਣੇ ਹੁੰਦੇ ਹਨ ਤੋ ਜੋ ਕਿ ਬਿਨਾਂ ਫੋਨ ਤੋਂ ਬਿਨਾਂ ਫੋਨ ਤੋਂ ਨਹੀਂ ਲਗਾਏ ਜਾ ਸਕਦੇ ਇਸ ਲਈ ਰੋਜਮਰਾ ਦੀ ਜ਼ਿੰਦਗੀ ਵਿੱਚ ਇੱਕ ਜੋ ਮੋਬਾਈਲ ਫੋਨ ਹੈ ਉਹ ਇੱਕ ਸਰੀਰ ਦਾ ਅੰਗ ਬਣ ਗਿਆ ਹੈ ਜਿਸ ਜਿਸ ਤੋਂ ਬਿਨਾਂ ਨਹੀਂ ਅ ਅੱਜ ਨਹੀਂ ਰਿਹਾ ਜਾ ਸਕਦਾ ਇਸ ਲਈ ਅਸੀਂ ਇੱਕ ਮੋਬਾਈਲ ਨੂੰ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਮੰਨ ਕੇ ਅੱਗੇ ਲੈ ਕੇ ਜਾ ਜਾਂਦੇ ਹਾਂ ਜਿਸ ਲਈ ਅਸੀਂ ਮੋਬਾਈਲ ਮੋਬਾਈਲ ਦੇ ਬਿਨਾਂ ਜਰਾ ਵੀ ਨਹੀਂ ਰਹਿ ਸਕਦੇ ਮੋਬਾਇਲ ਇੱਕ ਬਿਹਤਰੀਨ ਇੱਕ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਜਿਸ ਨੂੰ ਅਸੀਂ ਅੱਗੇ ਹੋਰ ਵਧੀਆ ਤਰੱਕੀ ਕਰ ਸਕਦੇ ਹਨ ਜਿਵੇਂ ਕਿ ਹੁਣ ਮੈਂ ਯੂਪੀਐਸਸੀ ਦੀ ਤਿਆਰੀ ਕਰਦਾ ਹਾਂ ਅਤੇ ਮੈਨੂੰ ਕੋਈ ਕੁਛ ਵੀ ਚੀਜ਼ ਦੀ ਜ਼ਰੂਰਤ ਹੋਵੇ ਮੈਂ ਪੜ੍ਹਨਾ ਹੋਵੇ ਕੁਛ ਲਿਖਣਾ ਹੋਵੇ ਅਤੇ ਉਹ ਮੋਬਾਇਲ ਥਰੂ ਮੈਂ ਆਪਣਾ ਕੰਮ ਕਰ ਸਕਦਾ ਹਾਂ ਇਸ ਲਈ ਸਾਡੀ ਰੋਜ਼ਮਰਾ ਜ਼ਿੰਦਗੀ ਵਿੱਚ ਮੋਬਾਇਲ ਦਾ ਇੱਕ ਬਹੁਤ ਹੀ ਮਹੱਤਵਪੂਰਨ ਰੋਲ ਮੇਰੀ ਜ਼ਿੰਦਗੀ ਵਿੱਚ ਆਜ ਆਦਾ ਹੁੰਦਾ ਹੈ ਇਸ ਲਈ ਮੋਬਾਇਲ ਤੋਂ ਬਿਨਾਂ ਤੋਂ ਰਿਹ ਨਹੀਂ ਰਿਹਾ ਜਾ ਸਕਦਾ ਅੱਜ ਦੇ ਟਾਈਮ ਵਿੱਚ ਇਸ ਲਈ ਮੋਬਾਇਲ ਬਹੁਤ ਹੀ ਜ਼ਰੂਰੀ ਟੈਕਨੋਲੋਜੀ ਬਣ ਚੁੱਕੀ ਹੈ ਸਾਡੀ ਰੋਜ਼ਮਰਾ ਜ਼ਿੰਦਗੀ ਵਿੱਚ